ਮੈਂ ਸਕੂਲ ਵਿੱਚ ਪੇਂਟਿੰਗ ਦਾ ਬਹੁਤ ਸ਼ੌਂਕ ਸੀ ਮੈਨੂੰ ਅਸੀਂ ਪੇਂਟਿੰਗ ਕਰਦੇ ਹੁੰਦੇ ਸੀ ਹੈ ਨਾ ਅਤੇ ਜਦੋਂ ਸਕੂਲੋਂ ਸਿਖਾਂਉਦੇ ਹੁੰਦੇ ਸੀ ਪੇਂਟਿੰਗ ਫਿਰ ਹੌਲੀ ਹੌਲੀ ਵੱਡੇ ਹੋਏ ਫਿਰ ਪੇਂਟਿੰਗ ਦੇ ਥਰੂ ਫਿਰ ਮੈਂ ਆਪਣੇ ਸਿਲਾਈ ਵਿੱਚ ਸਿੱਖਣ ਲੱਗ ਗਈ ਫਿਰ ਮੈਂ ਆਪਣੇ ਸੂਟਾਂ 'ਤੇ ਪੇਂਟਿੰਗ ਕਰਨੀ ਵਧੀਆ ਵਧੀਆ ਫਲਾਵਰ ਮਤਲਬ ਮੈਨੂੰ ਬਹੁਤ ਵਧੀਆ ਲੱਗਦੀ ਸੀ ਪੇਂਟਿੰਗ ਸ਼ੁਰੂ ਤੋਂ ਹੀ ਅਤੇ ਫਰਾਕਾਂ 'ਤੇ ਪੇਂਟਿੰਗ ਕਰਨੀ ਉਸ ਤਰ੍ਹਾਂ ਵੀ ਘਰ ਵੀ ਮੇਰੇ ਪੇਂਟਿੰਗ ਵਗੈਰਾ ਕੀਤੀਆਂ ਹੋਈਆਂ ਮੈਂ ਪਈਆਂ ਹੋਈਆਂ ਘਰ ਜਦੋਂ ਕਰਦੇ ਸੀ ਤਾਂ ਚਲੋ ਉਹਨੂੰ ਫਿਰ ਸ਼ੌਕ ਵਜੋਂ ਰਿਹਾ ਪਰ ਕਰੀਅਰ ਚਲੋ ਸਟਿਚਿੰਗ ਦਾ ਚੁਣਿਆ ਚਲੋ ਪਰ ਅਜੇ ਵੀ ਸਟਿਚਿੰਗ ਦੇ ਸੂਟਾਂ 'ਤੇ ਵੀ ਪੇਂਟਿੰਗ ਆਪਣੇ ਬੱਚਿਆਂ ਦੇ ਸੂਟਾਂ 'ਤੇ ਵੀ ਪੇਂਟਿੰਗ ਕਰਦੀ ਹਾਂ ਮੈਂ ਕਿ ਜਦੋਂ ਵੀ ਮੌਕਾ ਮਿਲਦਾ ਵਾ ਮੈਨੂੰ ਉਹਨੇ ਪ੍ਰੇਰਿਤ ਕੀਤਾ ਕਿ ਮੈਂ ਸ਼ੌਂਕ ਵਜੋਂ ਕਰਦੀ ਸੀ ਪਰ ਮੈਨੂੰ ਵਧੀਆ ਲੱਗਦੀ ਹੈ ਕਿ ਮੈਂ ਹਾਂ ਪੇਂਟਿੰਗ ਕਰਾਂ ਵੀ ਮੇਰੇ ਘਰ 'ਚ ਵੀ ਪੇਂਟਿੰਗ ਹੈ ਕੀਤੀਆਂ ਹੋਈਆਂ ਮੈਂ ਜਦੋਂ ਵੀ ਮਤਲਬ ਕਰਦੀ ਹੁੰਦੀ ਸੀ ਬਚਪਨ ਦੇ ਵਿੱਚ